ਮੇਰੇ ਜ਼ਿੰਦਗੀ ਵਿੱਚ ਬਹੁਤ ਜ਼ਿਅਦਾ ਦਾ ਮਹੱਤਵਪੂਰਨ ਫ਼ੈਸਲੇ ਆਏ ਪਰ ਇਹਨਾਂ ਸਾਰੇ ਫ਼ੈਸਲਿਆਂ ਵਿੱਚੋਂ ਮੇਰਾ ਇੱਕ ਫ਼ੈਸਲਾ ਬਹੁਤ ਜਰੂਰੀ ਸੀ ਕਿ ਮੈਂ ਆਪਣੇ ਬੱਚਿਆਂ ਨੂੰ ਬਹੁਤ ਪੜ੍ਹਾਇਆ ਅਤੇ ਫੇਰ ਉਹਨਾਂ ਨੂੰ ਬੀ ਟੈਕ ਵਗੈਰਾ ਵੀ ਕਰਵਾਈ ਅੱਛੀ ਪੜ੍ਹਾਈ ਕਰਾ ਕੇ ਵੀ ਸਾਡੇ ਬੱਚਿਆਂ ਨੂੰ ਇੱਥੇ ਨੌਕਰੀਆਂ ਨਹੀਂ ਮਿਲੀਆਂ ਨਾ ਨੌਕਰੀਆਂ ਮਿਲਣ ਕਰਕੇ ਫੇਰ ਅਸੀਂ ਸੋਚਿਆ ਬਹੁਤ ਦਿਲ 'ਤੇ ਪੱਥਰ ਰੱਖ ਕੇ ਵਈ ਹੁਣ ਕੀ ਕਰੀਏ ਫੇਰ ਅਸੀਂ ਆਪਣੇ ਮਾਤਾ ਪਿਤਾ ਦੀ ਸਲਾਹ ਲਈ ਵਈ ਹੁਣ ਕਿਹੜਾ ਰਸਤਾ ਬੱਚਿਆਂ ਲਈ ਦੇਖੀਏ ਤਾਂ ਸਾਨੂੰ ਬਾਹਰ ਦਾ ਰਸਤਾ ਹੀ ਦੇਖਣਾ ਪਿਆ ਬਹੁਤ ਕਸ਼ਟ ਆਏ ਬਾਹਰ ਭੇਜਣੇ ਵੀ ਬੱਚੇ ਬਹੁਤ ਔਖੇ ਆ ਤੁਹਾਨੂੰ ਪਤਾ ਹੀ ਹੈ ਕਿ ਬੱਚਿਆਂ ਦੇ ਜਾਣ ਲਈ ਕਿੰਨਾ ਪੈਸਾ ਚਾਹੀਦਾ ਹੈ ਕਿੰਨੀਆਂ ਮੁਸਕਲਾਂ ਆਉਂਦੀਆਂ ਹਨ ਅਸੀਂ ਬਹੁਤ ਆਪਣੇ ਦਿਲ 'ਤੇ ਪੱਥਰ ਰੱਖ ਕੇ ਬੱਚਿਆਂ ਨੂੰ ਅੱਜ ਦਿਨ ਬਾਹਰ ਭੇਜਿਆ ਹੈ